ਕੀ ਸਾਡੇ ਜੋ ਕਿ ਗੁਰੂ ਘਰ ਦੀਆਂ ਸੰਸਥਾਵਾਂ ਹਨ ਅਤੇ ਸਾਡਾ ਫ਼ਰਜ਼ ਇਹ ਬਣਦਾ ਹਨ ਕਿ ਅਸੀਂ ਸਵੇਰੇ ਉੱਠ ਕੇ ਤੜਕੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਦੇ ਦਰਸ਼ਨ ਦਿਦਾਰੇ ਕਰਾਈਏ ਕਰੀਏ ਕਰਕੇ ਆਪ ਮਹਾਰਾਜ ਸਭ ਦਾ ਭਲਾ ਮੰਗੀਏ ਸਰਬੱਤ ਦਾ ਭਲਾ ਮੰਗੀਏ ਮੰਗ ਕੇ ਜੇ ਅਸੀਂ ਸਰਬੱਤ ਦਾ ਭਲਾ ਮੰਗਾਂਗੇ ਤਾਂ ਗਰੀਬ ਦੇ ਗਰੀਬ ਦਾ ਵੀ ਭਲਾ ਹੋਵੇਗਾ ਅਤੇ ਬਾਣੀ ਦੇ ਅਨੁਸਾਰ ਜੋ ਕਿ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਹੈ ਅਤੇ ਕਰਕੇ ਵੰਡ ਕੇ ਛਕਣਾ ਹਨ ਗੁਰੂ ਮਰਿਆਦਾ ਦੇ ਨਾਲ਼ ਬਾਣੀ ਦੇ ਹਿਸਾਬ ਦੇ ਨਾਲ਼ ਆਪਾਂ ਨੂੰ ਗੁਰੂ ਘਰ ਦੀਆਂ ਹਦਾਇਤਾਂ ਦੇ ਨਾਲ਼ ਜੁੜ ਕੇ ਗੁਰੂ ਘਰ ਤੋਂ ਵੱਧ ਤੋਂ ਵੱਧ ਹੱਥੀ ਸੇਵਾ ਪੈਸੇ ਵਾਲ਼ੀ ਸੇਵਾ ਉਹ ਹਰ ਤਰ੍ਹਾਂ ਦੀ ਸੇਵਾ ਆਪਾਂ ਕਰ ਸਕਦੇ ਹਨ ਕੋਈ ਮਨਾਹੀ ਨਹੀਂ ਪੰਜਾਬੀ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਪ੍ਰਕਾਸ਼ ਹਨ ਅਤੇ ਅਸੀਂ ਵੀ ਬਾਣੀ ਪੜ੍ਹਦੇ ਸੁਣਦੇ ਆਪਣੀਆਂ ਅੱਖਾਂ ਦੇ ਨਾਲ਼ ਗੁਰੂ ਘਰ ਦੀਆਂ ਕਈ ਵਾਰੀ ਸਾਨੂੰ ਸੇਵਾ ਮਿਲ ਜਾਂਦੀਆਂ ਹਨ ਭਾਈ ਚੌਲ਼ ਸਾਹਿਬ ਦੇ ਦ ਕਰੋ ਗੁਰੂ ਘਰ ਦੇ ਉਹ ਵੀ ਸੇਵਾ ਸਾਨੂੰ ਮਹਾਰਾਜ ਦਿੰਦਾ ਹੈ ਵੱਧ ਤੋਂ ਵੱਧ ਸਾਡੇ ਘਰਾਂ ਵਿੱਚ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ ਕਿ ਜੋ ਮੰਗਿਆ ਆਪਣੇ ਗੁਰੂ ਤੋਂ ਉਹ ਸਾਨੂੰ ਦਿੰਦਾ ਹੈ